ਜੇਕਰ ਗੱਲ ਕਰੀਏ ਅੱਜ ਦੇ ਯੁੱਗ ਦੀ ਤਾਂ ਅੱਜ ਦਾ ਯੁੱਗ ਵਿਗਿਆਨਿਕ ਯੁੱਗ ਹੈ ਜਿਹਦੇ ਵਿੱਚ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਜਿਹਦੇ ਵਿੱਚ ਬਹੁਤ ਸਾਰੀ ਤਕਨੋਲਜੀ ਦੀਆਂ ਚੀਜ਼ਾਂ ਸਾਨੂੰ ਵੇਖਣ ਸੁਣਨ ਨੂੰ ਮਿਲਦੀਆਂ ਨੇ ਕ ਇਹਨਾਂ ਵਿੱਚੋਂ ਇਸ ਟਕਨੋਲਜੀ ਦੀਆਂ ਚੀਜ਼ਾਂ ਵਿੱਚੋਂ ਜੇ ਗੱਲ ਕਰੀਏ ਅਸੀਂ ਪਿਛਲੇ ਸਮੇਂ ਨੂੰ ਲੈ ਕੇ ਤਾਂ ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਸਨ ਚੀਜ਼ਾਂ ਇੱਦਾਂ ਦੀਆਂ ਸਨ ਜੋ ਸਾਨੂੰ ਵੇਖਣ ਸੁਣਨ ਨੂੰ ਮਿਲਦੀਆਂ ਸੀ ਕਿ ਪਹਿਲੇ ਲੋਕ ਫ਼ੋਨ 'ਤੇ ਗੱਲ ਨਹੀਂ ਸੀ ਕਰ ਪਾਉਂਦੇ ਜੋ ਵੀ ਗੱਲ ਕਰਨੀ ਪੈਂਦੀ ਸੀ ਉਹ ਫੇਸ ਟੂ ਫੇਸ ਕਰਨੀ ਪੈਂਦੀ ਸੀ ਮਿਲਕੇ ਕਰਨੀ ਪੈਂਦੀ ਸੀ ਜਾਂ ਚਿੱਠੀਆਂ ਰਾਹੀਂ ਕਰਨੀ ਪੈਂਦੀ ਸੀ ਹਾਂ ਅਤੇ ਉਹਨਾਂ ਚਿੱਠੀਆਂ ਨੂੰ ਆਉਣ 'ਤੇ 'ਤੇ ਕਾਫ਼ੀ ਟਾਈਮ ਲੱਗ ਜਾਂਦਾ ਸੀ ਅਤੇ ਬਹੁਤ ਸਾਰਾ ਸਮਾਂ ਲੋਕਾਂ ਦੀ ਇੱਕ ਦੂਜੇ ਨਾਲ਼ ਗੱਲ ਨਹੀਂ ਸੀ ਹੁੰਦੀ ਪਰ ਅੱਜ ਟਕਨੋਲਜੀ ਦੇ ਬੇਸ 'ਤੇ ਜੇਕਰ ਗੱਲ ਕਰੀਏ ਮੋਬਾਈਲ ਫ਼ੋਨ ਦੀ ਤਾਂ ਮੋਬਾਈਲ ਫ਼ੋਨ ਦੇ ਕਰਕੇ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਇਹ ਵੀ ਇੱਕ ਟਕਨੋਲਜੀ ਦਾ ਸਾਧਨ ਹੈ ਕਿਉਂਕਿ ਟਕਨੋਲਜੀ ਦੇ ਕਰਕੇ ਹੀ ਸਾਰਾ ਕੁਛ ਸੀਮਿਤ ਹੋ ਪਾਇਆ ਹੈ ਲੋਕ ਇੱਕ ਦੂਜੇ ਨਾਲ਼ ਅਟੈਚ ਹੋਏ ਨੇ ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇੱਕ ਦੂਜੇ ਨਾਲ਼ ਗੱਲਾਂ ਕਰਦੇ ਨੇ ਠੀਕ ਹੈ ਅਤੇ ਹਰੇਕ ਚੀਜ਼ ਬਾਰੇ ਮਤਲਬ ਲੋਕਾਂ ਨੂੰ ਨੌਲੇਜ ਮਿਲਦੀ ਹੈ ਟੈਕਨੋਲਜੀ ਦੇ ਹਿੱਸੇ 'ਚ ਗੱਲ ਕਰੀਏ ਤਾਂ ਟੀ ਵੀ ਟੈਕਨੋਲਜੀ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਾਧਨ ਹੈ ਜਿਸ ਵਿੱਚ ਹਰੇਕ ਖ਼ਬਰ ਦੇਖਣ ਨੂੰ ਮਿਲਦੀ ਹੈ ਹਰੇਕ ਖ਼ਬਰ ਨਾਲ਼ ਲੋਕ ਜੁੜਦੇ ਨੇ ਜੇ ਉਹ ਭਾਵੇਂ ਬਾਹਰ ਦੀ ਹੋਵੇ ਭਾਵੇਂ ਪੰਜਾਬ ਦੀ ਹਰੇਕ ਸੂਬੇ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ ਠੀਕ ਹੈ ਅਤੇ ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਲੋਕ ਜੇਕਰ ਆਪਣਾ ਭੁਗਤਾਨ ਕਰਦੇ ਸੀ ਪੈਸੇ ਦਾ ਲੈਣ ਦੇਣ ਕਰਦੇ ਸੀ ਤਾਂ ਉਹ ਵੀ ਸਭ ਨੂੰ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਕਰਨਾ ਪੈਂਦਾ ਸੀ ਨਾ ਅਤੇ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਭ ਤੈਕਨੋਲਜੀ 'ਤੇ ਡਿਪੈਂਡ ਹੈਗੀਆਂ ਕਿਉਂਕਿ ਹੁਣ ਗੂਗਲ ਪੇ ਵਗੈਰਾ ਸਭ ਕੁਛ ਪੇ ਕਾਰਡ ਸਮਾਂ ਸ ਕਾਰਡ ਵਗੈਰਾ ਯੂਜ਼ ਹੁੰਦੇ ਨੇ ਇਹ ਸਾਰਾ ਕੁਛ ਯੂਜ਼ ਹੁੰਦਾ ਇਹ ਸਭ ਤੈਕਨੋਲਜੀ ਦੀ ਦੇਣ ਹੈ ਕਿ ਹੁਣ ਤਾਂ ਜੇਕਰ ਕਹੀਏ ਅੱਜ ਦਾ ਯੁੱਗ ਬਹੁਤ ਹੀ ਡਿਵੈਲਪ ਹੋ ਚੁੱਕਾ